ਹਾਂਜੀ ਜਸ਼ਨ ਜੀ ਕੀ ਹਾਲ ਚਾਲ ਬਸ ਵਧੀਆ ਮੈਂ ਕਿਹਾ ਆਪਣੀ ਗ੍ਰੈਜੂਏਸ਼ਨ ਕੰਪਲੀਟ ਹੋਏ ਨੂੰ ਸਾਲ ਹੋ ਗਿਆ ਜਸ਼ਨ ਨਾਲ ਗੱਲ ਹੀ ਨਹੀਂ ਮੈਂ ਸੋਚਿਆ ਕੋਲ ਕਰਕੇ ਗੱਲ ਹੀ ਕਰ ਲਈਏ ਹਾਂਜੀ ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਇਸੇ ਟੋਪਿਕ 'ਤੇ ਗੱਲ ਕਰਨ ਲਈ ਫ਼ੋਨ ਕੀਤਾ ਸੀਗਾ ਤੁਸੀਂ ਜੋਬ ਵਗੈਰਾ ਕੀਤੀ ਕੋਈ ਹਜੇ ਕਿ ਨਹੀਂ ਜੋਬ ਵਗੈਰਾ ਦਾ ਟਰਾਈ ਕੀਤਾ ਕਿਤੇ ਮੈਂ ਨਾ ਜੋਬ ਕੀਤੀ ਉੱਥੇ ਰਿਲਾਇੰਸ ਮਾਟ ਆਪਣੇ ਤਰਨ ਤਾਰਨ ਹੈਗਾ ਇੱਥੇ ਮੈਂ ਅੱਠ ਹਜ਼ਾਰ 'ਤੇ ਜੋਬ ਕੀਤੀ ਛੇ ਮਹੀਨੇ ਅਤੇ ਮੈਂ ਫਿਰ ਸੋਚਿਆ ਯਾਰ ਕਿ ਆਪਾਂ ਗ੍ਰੈਜੂਏਸ਼ਨ ਇੰਨੀ ਤਿੰਨ ਸਾਲਾਂ ਦੀ ਗ੍ਰੈਜੂਏਸ਼ਨ ਕੀਤੀ ਆ ਅਤੇ ਤਨਖਾਹ 'ਤੇ ਆਪਾਂ ਕੁਛ ਵੀ ਨਹੀਂ ਲੈਣ ਡੇ ਅਤੇ ਮੈਂ ਸੋਚਿਆ ਨਾ ਯਾਰ ਆਪਾਂ ਆਈਫੋਨ ਸੇਲ ਪਰਚੇਜ਼ ਦਾ ਕੰਮ ਸ਼ੁਰੂ ਕਰੀਏ ਦੁਕਾਨ ਮੇਰੇ ਤੋਂ ਹੈਗੀ ਆ ਅਤੇ ਆਪਾਂ ਰੈ ਹਾਂ ਅਤੇ ਆਪਾਂ ਬਿਲ ਬੁਲ ਜਿਹੜਾ ਅੱਧਾ ਅੱਧਾ ਕੱਢ ਲਿਆ ਕਰਾਂਗੇ ਅਤੇ ਪ੍ਰੋਫਿਟ ਵੀ ਅੱਧਾ ਅੱਧਾ ਅਤੇ ਜਿੰਨੀ ਕੁ ਇਨਵੈਸਟਮੈਂਟ ਹੋਣੀ ਆਪਣੀ ਡੇਢ ਦੋ ਲੱਖ ਰੁਪਇਆ ਲੱਗਣਾ ਆਪਣਾ ਸਟਾਰਟ ਕਰਨ 'ਤੇ ਉੱਥੇ ਕਰ ਲੈਂਦੇ ਹਾਂ ਉੱਥੇ ਫਿਰ ਆਪਾਂ ਨੂੰ ਦੁਕਾਨ ਹੀ ਲੈਣੀ ਪੈਣੀ ਰੈਂਟ 'ਤੇ ਆਪਾਂ ਲੈ ਲੈਂਦੇ ਹਾਂ ਅਤੇ ਨਾਲੇ ਆਪਣਾ ਉੱਧਰ ਕੰਮ ਚੱਲ ਵੀ ਪੈਣਾ ਕਿਉਂਕਿ ਲੋਕ ਬਥੇਰੇ ਹੁੰਦੇ ਉੱਧਰ ਫ਼ੋਨ ਲੈਣ ਚਲੋ ਫਿਰ ਆਪਾਂ ਐਂ ਕਰਦੇ ਹਾਂ ਆਪਾਂ ਸ਼ਾਮੀ ਸੱਤ ਵਜੇ ਮਿਲਦੇ ਹਾਂ ਅਤੇ ਬਹਿ ਕੇ ਸਲਾਹ ਕਰਦੇ ਹਾਂ ਫਿਰ ਠੀਕ ਹੈ ਜੀ ਓਕੇ ਜੀ